ਅੱਜਕਲ ਸਲਵਾਰਾਂ ਦੀਆਂ ਬਹੁਤ ਕਿਸਮਾਂ ਚੱਲ ਗਈਆਂ ਹਨ ਅਫਗਾਨੀ ਸਲਵਾਰ ਟੂਲਿਪ ਸਲਵਾਰ ਪਟਿਆਲਾ ਸਲਵਾਰ ਸਟੇਟ ਸਲਵਾਰ ਚੂੜੀਦਾਰ ਸਲਵਾਰ ਅਫਗਾਨੀ ਸਲਵਾਰ ਤਾਂ ਸਿੰਪਲ ਹੀ ਹੁੰਦੀ ਹੈ ਜਿਹੜੀ ਪਟਿਆਲਾ ਸਲਵਾਰ ਹੈ ਤਿੰਨ ਮੀਟਰ ਕੱਪੜਾ ਲੱਗਦਾ ਹੈ ਤੇ ਗਾਹਕ ਨੂੰ ਪਹਿਲਾਂ ਹੀ ਕਹਿ ਦੀ ਦਾ ਇਹਦੇ ਤੇ ਕੱਪੜਾ ਜਿਆਦਾ ਲੱਗਦਾ ਹੈਗਾ ਕੱਲ ਨੂੰ ਫਿਰ ਨਾ ਕਹੀਓ ਸਾਡਾ ਪੰਜ ਮੀਟਰ ਕੱਪੜਾ ਸੀ ਸਾਡਾ ਚਾਰ ਮੀਟਰ ਕੱਪੜਾ ਸੀਗਾ ਤਿੰਨ ਮੀਟਰ ਕੱਪੜਾ ਕਟਿੰਗ ਕਰਵਾ ਕੇ ਦੇਖ ਲਓ ਫਿਰ ਉਸ ਤੋਂ ਬਾਅਦ ਸਟੇਟ ਸਲਵਾਰ ਹੁੰਦੀ ਆ ਉਹਦੇ ਤੇ ਢਾਈ ਮੀਟਰ ਕੱਪੜਾ ਲੱਗਦਾ ਹੈਗਾ ਢਾਈ ਮੀਟਰ ਕੱਪੜੇ ਦੇ ਵਿੱਚ ਖੁੱਲੀ ਸਲਵਾਰ ਬਣ ਜਾਂਦੀ ਹੈ ਇੱਕ ਡੇਢ ਮੀਟਰ ਦੀ ਸਲਵਾਰ ਹੁੰਦੀ ਹੈ ਉਹ ਡੇਢ ਮੀਟਰ ਚ ਸਟੇਟ ਸਲਵਾਰ ਸਿੰਪਲ ਬਿਲਕੁਲ ਘੱਟ ਚੋਣਾਂ ਪੈਂਦੀਆਂ ਨੇ ਬਣ ਠੀਕ ਜਾਂਦੀ ਹੈ ਵੈਸੇ ਬਾਕੀ ਪਹਿਲੇ ਪਲਾਜੋ ਦਾ ਰਿਵਾਜ਼ ਚੱਲਿਆ ਸੀ ਹੁਣ ਫਿਰ ਸਲਵਾਰਾਂ ਦਾ ਰਿਵਾਜ ਆ ਗਿਆ ਪਲਾਜੋ ਬੰਦ ਹੋ ਗਏ ਨੇ ਹੁਣ ਸਲਵਾਰਾਂ ਫਿਰ ਚੱਲ ਪਈਆਂ ਨੇ